ਸਤਿ ਸ਼੍ਰੀ ਅਕਾਲ ਕੀ ਮੇਰੀ ਗੱਲ ਲੱਕੀ ਢਾਬੇ ਨਾਲ ਹੋ ਰਹੀ ਹੈ ਮੈਨੂੰ ਦੋ ਘੰਟੇ ਪਹਿਲਾਂ ਮੇਰੇ ਵੱਲੋਂ ਦਿੱਤਾ ਔਡਰ ਮਿਲਿਆ ਹੈ ਜਿਸ ਦੀ ਹਾਲਤ ਬਹੁਤ ਹੀ ਬੁਰੀ ਹੈ ਸਭ ਤੋਂ ਪਹਿਲਾਂ ਮੈਂ ਦਾਲ ਦੇ ਬਾਰੇ ਦੱਸਣਾ ਚਾਵਾਂਗੀ ਕਿ ਦਾਲ ਅਤੇ ਸਬਜ਼ੀ ਦਾ ਆਪਸ ਵਿੱਚ ਰ ਰਲਿਆ ਮਿਲਿਆ ਭੋਜਨ ਮੈਨੂੰ ਮਿਲਿਆ ਹੈ ਇਸ ਤੋਂ ਇਲਾਵਾ ਰੋਟੀ ਰੋਟੀ ਦੀ ਹਾਲਤ ਵੀ ਸਹੀ ਨਹੀਂ ਸੀ ਮੈਨੂੰ ਲੱਗ ਰਿਹਾ ਕਿ ਇਹ ਬਹੁਤ ਜ਼ਿਆਦਾ ਪੁਰਾਣੀ ਜਾਂ ਕੱਲ੍ਹ ਦਾ ਬਾਸੀ ਭੋਜਨ ਮੈਨੂੰ ਪ੍ਰਦਾਨ ਕੀਤਾ ਗਿਆ ਹੈ ਅਤੇ ਉਸ ਤੋਂ ਇਲਾਵਾ ਇਹਦੇ ਵਿੱਚੋਂ ਬਦਬੂ ਵੀ ਆ ਰਹੀ ਸੀ ਜਿਸ ਤੋਂ ਸਾਫ ਪ੍ਰਗਟ ਹੋ ਰਿਹਾ ਕਿ ਕੱਲ੍ਹ ਦਾ ਬਾਸੀ ਬਾਹਾ ਭੋਜਨ ਮੈਨੂੰ ਦਿੱਤਾ ਗਿਆ ਹੈ ਮੈਂ ਤੁਹਾਡੇ ਵੱਲੋਂ ਦਿੱਤੀਆਂ ਸਹੂਲਤਾਂ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ ਅਤੇ ਮੈਂ ਤੁਹਾਨੂੰ ਇੱਕੋ ਬੇਨਤੀ ਕਰਨਾ ਚਾਵਾਂਗੀ ਕਿ ਜਾਂ ਤਾਂ ਮੈਨੂੰ ਤਾਜ਼ਾ ਭੋਜਨ ਪ੍ਰਦਾਨ ਕੀਤਾ ਜਾਵੇ ਨਹੀਂ ਤਾਂ ਫਿਰ ਮੈਨੂੰ ਮੇਰੇ ਪੈਸੇ ਵਾਪਸ ਕਰ ਦਿੱਤੇ ਜਾਣ